ਔਰਤਾਂ ਨੂੰ ਪਹਿਲਾਂ ਘਰ ਦੇ ਕੰਮ ਅਤੇ ਬੱਚਿਆਂ ਦੀ ਸਾਂਭ ਸੰਭਾਲ ਲਈ ਹੀ ਦੇਖਿਆ ਜਾਂਦਾ ਸੀ ਕਿਉਂਕਿ ਉਹ ਉਹਨਾਂ ਨੂੰ ਇਹ ਸਮਝਿਆ ਜਾਂਦਾ ਸੀ ਵੀ ਇਹ ਬਸ ਘਰ ਦੇ ਕੰਮ ਹੀ ਕਰ ਸਕਦੀਆਂ ਅਤੇ ਜਾਂ ਬੱਚਿਆਂ ਦੀ ਸਾਂਭ ਸੰਭਾਈ ਕਰ ਸਕਦੀਆਂ ਇਸ ਤੋਂ ਉੱਪਰ ਕੋਈ ਨਹੀਂ ਪਰ ਹੁਣ ਨਵੇਂ ਯੁੱਗ ਦੇ ਨਾਲ ਨਾਲ ਜਿਹੜਾ ਕਿ ਔਰਤਾਂ ਦੇ ਕੰਮ ਕਾਰਾਂ ਵਿੱਚ ਕਾਫ਼ੀ ਬਦਲਾਅ ਆਇਆ ਕਿਉਂਕਿ ਉਹ ਆਪਣੇ ਬਿਜਨਸ ਵੀ ਤੋਰ ਰਹੀਆਂ ਨੇ ਔਰਤਾਂ ਆਪਣੇ ਕਾਰੋਬਾਰ ਤੋਰ ਰਹੀਆਂ ਨੇ ਹਰ ਇੱਕ ਤਰ੍ਹਾਂ ਦਾ ਹੈ ਨਾ ਅਤੇ ਆਪਣੇ ਘਰ ਵਾਲੇ ਦੇ ਬਿਜਨਸ ਦੇ ਵਿੱਚ ਵੀ ਹੱਥ ਵਟਾ ਰਹੀਆਂ ਨੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਵੀ ਜੋੜ ਕੇ ਖੜ੍ਹੀਆਂ ਜਿਹੜਾ ਕਿ ਔਰਤਾਂ ਨੂੰ ਇੱਕ ਬੰਦਿਆਂ ਦੇ ਬਰਾਬਰ ਸਮਝਿਆ ਜਾਣ ਲੱਗਿਆ ਹਰ ਇੱਕ ਦਫ਼ਤਰ ਦੇ ਵਿੱਚ ਵੀ ਔਰਤਾਂ ਦੀਆਂ ਇੱਕ ਪੋਸਟਾਂ ਹੁੰਦੀਆਂ ਜਾਣੀ ਕਿ ਪੋਸਟਾਂ ਔਰਤਾਂ ਵੀ ਲੜਕਿਆਂ ਦੇ ਨਾਲ ਕੰਮ ਕਰਦੀਆਂ ਕਿਸੇ ਵੀ ਤਰ੍ਹਾਂ ਕਲਰਕ ਦੀ ਪੋਸਟ ਹੈ ਚਾਹੇ ਉਹ ਕੋਈ ਹੋਰ ਹੈ ਪ੍ਰਾਈਵੇਟ ਨੋਕਰੀ ਹੋ ਗਈ ਜਾਂ ਸਰਕਾਰੀ ਨੋਕਰੀ ਹੋ ਗਈ ਹਰ ਇੱਕ ਥਾਂ 'ਤੇ ਔਰਤ ਨੂੰ ਵੀ ਬੰਦਿਆਂ ਦੇ ਪਹਿਲ ਦਿੱਤੀ ਜਾਂਦੀ ਹੈ ਵੀ ਉਹ ਜੋਬ ਕਰ ਸਕਦੀ ਹੈ ਉੱਥੇ ਨੋਕਰੀ ਕਰ ਸਕਦੀ ਹੈਗੀ ਹੈ ਨਾ ਇਸਦੇ ਨਾਲ ਨਾਲ ਵੀ ਉਹ ਆਪਣੇ ਘਰ ਵਾਲੇ ਨਾਲ ਉਸਦੇ ਬਿਜਨਸ ਦੇ ਵਿੱਚ ਉਸਦੇ ਕੰਮ ਕਾਰ ਦੇ ਵਿੱਚ ਵੀ ਹੱਥ ਵਟਾਉਦੀਆਂ ਨੇ ਵੀ ਅੱਜ ਦੀ ਘੜੀ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਦੇ ਬਰਾਬਰ ਹੀ ਜਾ ਰਹੀਆਂ ਨੇ ਲੜਕਿਆਂ ਦੇ ਬੰਦਿਆਂ ਦੇ ਬਰਾਬਰ ਹੀ ਕੰਮ ਕਰ ਰਹੀਆਂ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜੋ ਬਿਜਨਸ ਦਾ ਕੰਮ ਹੈ ਉਹਨਾਂ ਦਾ ਆਪਣਾ ਕੰਮ ਹੈ ਚਾਹੇ ਉਹ ਨੌਕਰੀ ਲਾ ਲਉ ਪ੍ਰਾਈਵੇਟ ਲਾ ਲਉ ਸਰਕਾਰੀ ਲਾ ਲਉ ਕਿਸੇ ਵੀ ਅਦਾਰੇ 'ਤੇ ਉਹ ਬੰਦਿਆਂ ਦੇ ਬਰਾਬਰ ਹੀ ਕੰਮ ਕਰਦੀਆਂ ਨੇ ਅਤੇ ਪਹਿਲਾਂ ਨਾਲੋਂ ਇਹਨਾਂ ਦੇ ਜਿਹੜਾ ਹੈਗਾ ਗਾ ਕਾਫ਼ੀ ਬਦਲਾਅ ਆਇਆ ਹੋਇਆ ਗਾ